ਸਾਡਾ ਬੈਂਕ ਜੋ ਸਥਾਨਕ ਹੀ ਹੈ ਕਰਜ਼ੇ ਮਿਊਚਲ ਫੰਡ ਅਤੇ ਕਾਰਡ ਰਾਹੀਂ ਸਾਡੀ ਸਹਾਇਤਾ ਕਰਨ ਦਾ ਯਤਨ ਕਰਦਾ ਰਹਿੰਦਾ ਹੈ ਬੈਂਕ ਵੱਲੋਂ ਕਾਰਡਾਂ 'ਤੇ ਛੋਟੇ ਲੋਨਾਂ ਦੀ ਸੈ ਸਹਾਇਤਾ ਉਪਲਬਧ ਹੈ ਇਸ ਤੋਂ ਇਲਾਵਾ ਮਿਊਚਲ ਫੰਡਾਂ ਰਾਹੀਂ ਵੀ ਸਾਡੀ ਸਹਾਇਤਾ ਕਰਦਾ ਹੈ ਮੈਨੂੰ ਵੀ ਇਸ ਸਬੰਧੀ ਇੱਕ ਤਜਰਬਾ ਹੈ ਕਿ ਮੈਨੂੰ ਇੱਕ ਛੋਟੇ ਲੋਨ ਦੀ ਲੋੜ ਪਈ ਤਾਂ ਮੈਂ ਬੈਂਕ ਨੂੰ ਐਪਲੀਕੇਸ਼ਨ ਦੇ ਕੇ ਬੇਨਤੀ ਕੀਤੀ ਗਈ ਜਿਸ ਦਾ ਉਹਨਾਂ ਨੇ ਬੜੇ ਹੀ ਵਧੀਆ ਢੰਗ ਨਾਲ ਮੈਨੂੰ ਲੋਨ ਦੀ ਉਪਲੱਬਧਤਾ ਕਰਾ ਕੇ ਦਿੱਤੀ ਅਤੇ ਮੇਰਾ ਤਜਰਬਾ ਕਾਫ਼ੀ ਸਾਡੀ ਸਥਾਨਕ ਬੈਂਕ ਜੋ ਕਿ ਪੀ ਐੱਨ ਬੀ ਹੈ ਵਧੀਆ ਰਿਹਾ